ਸਿੱਖਿਆ ਰੁਜ਼ਗਾਰ ਅਤੇ ਲੀਡਰਸ਼ਿਪ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਨੌਜਵਾਨਾਂ ਦੇ ਸਾਹਮਣੇ ਕਾਫੀ ਮੁੱਖ ਚੁਣੌਤੀਆਂ ਆਉਂਦੀਆਂ ਹਨ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਵਿੱਚ ਕਾਫੀ ਚੁਣੌਤੀਆਂ ਹਨ ਸਰਕਾਰੀ ਸਕੂਲਾਂ ਵਿੱਚ ਇੰਨੀ ਜ਼ਿਆਦਾ ਚੰਗੇ ਤਰੀਕੇ ਨਾਲ ਪੜ੍ਹਾਈ ਨਹੀਂ ਕਰਾਈ ਜਾਂਦੀ ਜਿਸ ਕਾਰਨ ਨਿਆ ਬੱਚਿਆਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਮਿਲਦੀ ਨਹੀਂ ਹੈ ਅਤੇ ਅਗਰ ਕੋਲੇਜਾਂ ਦੀ ਗੱਲ ਕਰੀ ਕੀਤੀ ਜਾਵੇ ਬੱਚੇ ਅਗਰ ਬਾਰਵੀਂ ਵੀ ਚੰਗੇ ਤਰੀਕੇ ਨਾਲ ਪਾਸ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਅੱਗੇ ਦੀ ਪੜ੍ਹਾਈ ਵਾਸਤੇ ਚੰਗੇ ਕੋਰਸਸ ਨਹੀਂ ਮਿਲਦੇ ਸਰਕਾਰੀ ਕੋਲੇਜ ਵਿੱਚ ਗ੍ਰੇਜੂਏਸ਼ਨ ਤੱਕ ਕੋਰਸਿਸ ਹਨ ਅਤੇ ਅੱਗੇ ਮਾਸਟਰ ਡਿਗਰੀ ਵਾਸਤੇ ਅਗਰ ਉੱਚ ਪੜ੍ਹਾਈ ਕਰਨੀ ਹੋਵੇ ਤਾਂ ਉਨ੍ਹਾਂ ਨੂੰ ਬਾਹਰ ਜਾਣਾ ਪੈਂਦਾ ਹੈ ਜਿਸ ਕਾਰਨ ਬੱਚੇ ਕੁਝ ਤਾਂ ਬਾਹਰ ਚਲੇ ਜਾਂਦੇ ਹਨ ਅਤੇ ਕੁਝ ਸਿੱਖਿਆ ਉੱਥੇ ਹੀ ਛੱਡ ਦਿੰਦੇ ਹਨ ਅਤੇ ਜਿਹੜੇ ਬੱਚੇ ਗ੍ਰੇਜੂਏਸ਼ਨ ਰੂਪਨਗਰ ਵਿੱਚ ਮਿਲਦੇ ਕੋਰਸਿਸ ਵਿੱਚ ਕਰਨੀ ਨਹੀਂ ਪਸੰਦ ਕਰਦੇ ਉਹ ਆਈਲੈਟਸ ਕਰ ਬਾਹਰ ਚਲੇ ਜਾਂਦੇ ਹਨ ਜੋ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਸੌਖਾ ਕੰਮ ਲੱਗਦਾ ਹੈ ਅਗਰ ਅਸੀਂ ਰੋਜ਼ਗਾਰ ਦੀ ਗੱਲ ਕੀਤੀ ਜਾ ਜਾਵੇ ਤਾਂ ਰੁਜ਼ਗਾਰ ਦੇ ਮੌਕੇ ਔਰ ਇੱਥੇ ਹਰੇਕ ਤਰੀਕੇ ਬਹੁਤ ਘੱਟ ਹਨ ਲੋਕੀਂ ਬਾਹ ਰੁਜ਼ਗਾਰ ਕ ਦੇ ਉਹਦੇ ਉੱਤੇ ਬਾਹਰ ਜਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਹਿਸਾਬ ਨਾਲ ਉਨ੍ਹਾਂ ਨੇ ਪੜ੍ਹਾਈ ਕੀਤੀ ਹੁੰਦੀ ਹੈ ਉਸ ਹਿਸਾਬ ਦੇ ਉਹਦੇ ਵਿੱਚ ਉਨ੍ਹਾਂ ਨੂੰ ਪੈਸੇ ਨਹੀਂ ਮਿਲਦੇ ਜਿ ਜਿਵੇਂ ਉਨ੍ਹਾਂ ਨੇ